ਸਾਡੇ ਖੇਤਰ ਵਿੱਚ ਹਸਪਤਾਲਾਂ ਦੀ ਬਹੁਤ ਹੀ ਵੱਡੀ ਕਮੀ ਹੈ ਇੱਥੇ ਸਿਰਫ ਇੱਕ ਦੋ ਹੀ ਸਰਕਾਰੀ ਹਸਪਤਾਲ ਹਨ ਜਿੱਥੇ ਡਾਕਟਰਾਂ ਦੀ ਵੀ ਬਹੁਤ ਜ਼ਿਆਦਾ ਕਮੀ ਹੈ ਇੱਥੇ ਸਿਰਫ ਇੱਕ ਦੋ ਹੀ ਡਾਕਟਰ ਹਨ ਜਿਸ ਕਰਕੇ ਲੋਕਾਂ ਦੀ ਜਿਹੜੀ ਇਲਾਜ ਹੈ ਉਹ ਲੇਟ ਕੀਤਾ ਜਾਂਦਾ ਹੈ ਜਿਸ ਕਰਕੇ ਲੋਕਾਂ ਨੂੰ ਬਹੁਤ ਹੀ ਲੰਬਾ ਸਮਾਂ ਇੰਤਜ਼ਾਰ ਅਤੇ ਲੰਬੇ ਭੀੜ ਵਿੱਚ ਖਲੋਣਾ ਪੈਂਦਾ ਹੈ ਬਹੁਤ ਹੀ ਲੰਬੇ ਲੰਬੇ ਟੋਕਨ ਦਿੱਤੇ ਜਾਂਦੇ ਹਨ ਜਿਸ ਵਿੱਚ ਲੋਕਾਂ ਨੂੰ ਬਹੁਤ ਹੀ ਲੰਬਾ ਇੰਤਜ਼ਾਰ ਕਰਨਾ ਪੈਂਦਾ ਹੈ ਜੇਕਰ ਟਾਈਮ ਵੱਧ ਲੱਗ ਜਾਵੇ ਤਾਂ ਲੋਕਾਂ ਨੂੰ ਕਈ ਕਈ ਦਿਨ ਤੱਕ ਇੰਤਜ਼ਾਰ ਵੀ ਕਰਨਾ ਪੈਂਦਾ ਹੈ ਜੇ ਜ਼ਿਆਦਾ ਜੇ ਮਰੀਜ਼ ਜ਼ਿਆਦਾ ਬਿਮਾਰ ਹੋਵੇ ਤਾਂ ਉਸਨੂੰ ਕਈ ਵਾਰ ਬਹੁਤ ਹੀ ਜ਼ਿਆਦਾ ਲੰਬਾ ਇੰਤਜ਼ਾਰ ਕਰਕੇ ਉਹ ਆਪਣੀ ਜਿਹੜੀ ਜ਼ਿੰਦਗੀ ਆ ਉਹ ਸਮਾਪਤ ਕਰ ਲੈਂਦਾ ਹੈ ਇਸ ਕਰਕੇ ਜਿਹੜੇ ਸਰਕਾਰਾਂ ਨੂੰ ਜਿਹੜੀਆਂ ਇਹ ਚੁਣੌਤੀਆਂ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਇਹ ਬਹੁਤ ਹੀ ਵੱਡਾ ਮਾਮਲਾ ਹੈ ਹਸਪਤਾਲਾਂ ਵਿੱਚ ਬਹੁਤ ਹੀ ਚੰਗੇ ਡਾਕਟਰ ਆਉਣੇ ਚਾਹੀਦੇ ਹਨ ਇੱਥੇ ਸਾਰੀਆਂ ਹੀ ਸੁਵਿਧਾਵਾਂ ਪ੍ਰਾਪਤ ਹੋਣੀਆਂ ਚਾਹੀਦੀਆਂ ਹਨ ਕਿਉਂਕਿ ਜਿਹੜਾ ਇਹ ਹਸਪਤਾਲ ਹੈ ਸਰਕਾਰੀ ਇਹ ਸਾਰਾ ਹੀ ਸਰਕਾਰਾਂ ਦੇ ਅਧੀਨ ਆਉਂਦਾ ਹੈ ਅਤੇ ਜੇ ਸਰਕਾਰਾਂ ਇਹਨਾਂ ਵੱਲ ਧਿਆਨ ਦੇਣ ਤਾਂ ਜਿਹੜੇ ਇਹ ਹ ਮੁਸੀਬਤਾਂ ਦਾ ਹੱਲ ਹੋ ਸਕਦਾ ਹੈ